ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਸੰਗਰੂਰ ਤੋਂ ਮਨਦੀਪ ਗੱਲ ਕਰ ਰਿਹਾ ਜੀ ਮੇਰੇ ਕਿਸੇ ਫਰੈਂਡ ਤੋਂ ਤੁਹਾਡਾ ਨੰਬਰ ਦਿੱਤਾ ਸੀਗਾ ਜੀ ਹਾਂ ਹਾਂਜੀ ਅਤੇ ਮੈਂ ਉਰੇ ਸੰਗਰੂਰ ਤੋਂ ਬੋਲ ਰਿਹਾ ਜੀ ਅਤੇ ਮੈਂ ਇੱਥੇ ਹੀ ਜੋਬ ਕਰ ਰਿਹਾ ਜੀ ਪਰ ਕਿਸੇ ਕਾਰਨਾਂ ਕਰਕੇ ਮੇਰੀ ਫੈਮਿਲੀ ਨੂੰ ਫਤਿਹਗੜ੍ਹ ਸਾਹਿਬ ਸ਼ਿਫਟ ਹੋਣਾ ਪੈ ਰਿਹਾ ਜੀ ਅਤੇ ਹੁਣ ਮੈਨੂੰ ਕੰਮ ਵੀ ਇੱਥੇ ਫਤਿਹਗੜ੍ਹ ਸਾਹਿਬ ਹੀ ਦੇਖਣਾ ਪਏਗਾ ਜੀ ਅਤੇ ਉਸੇ ਕੰਮ ਦੇ ਰਿਗਾਰਡਿੰਗ ਮੈਂ ਤੁਹਾਨੂੰ ਕੋਲ ਕੀਤੀ ਸੀ ਵੀ ਕੋਈ ਮੇਰੇ ਲਾਇਕ ਇੱਥੇ ਕੰਮ ਹੈਗਾ ਜੀ ਹਾਂਜੀ ਮੇਰੀ ਐਮਟੈਕ ਕੀਤੀ ਵੀ ਹੈ ਜੀ ਸਿਵਿਲ ਦੇ ਵਿੱਚ ਵੀ ਟੀਚਿੰਗ ਦੇ ਲਈ ਜਾਂ ਕੋਈ ਕੰਸਟਰਕਸ਼ਨ ਕੰਪਨੀ ਦੇ ਵਿੱਚ ਕਿਤੇ ਵੀ ਜੋਬ ਮਿਲ ਜਾਵੇ ਫਿਲਹਾਲ ਦੇ ਲਈ ਮੈਂ ਕਿਤੇ ਵੀ ਕਰ ਲਉਂਗਾ ਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਗੱਲ ਕਰ ਲਿਓ ਜੀ ਕਿਉਂਕਿ ਮੈਂ ਓਲਰੇਡੀ ਪਹਿਲਾਂ ਵੀ ਇੱਥੇ ਟੀਚਿੰਗ ਕੀਤੀ ਹੈ ਜੀ ਸੰਗਰੂਰ ਤਾਂ ਮੈਂ ਸੇਮ ਫੀਲਡ ਦੇ ਵਿੱਚ ਕੰਟੀਨਿਊ ਕਰ ਲਉਂਗਾ ਜੀ ਤੁਸੀਂ ਇਸ ਲਈ ਗੱਲ ਕਰ ਲਿਓ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸੇਮ ਨੰਬਰ 'ਤੇ ਹੈ ਜੀ ਮੈਨੂੰ ਕਰ ਦਿਉ ਮੈਂ ਤੁਹਾਨੂੰ ਆਪਣਾ ਰੈਜੁਮੇ ਵਗੈਰਾ ਸਾਰੇ ਡਾਕੂਮੈਂਟਸ ਵਗੈਰਾ ਜੋ ਵੀ ਹੈਗੇ ਆ ਮੈਂ ਸਾਰੇ ਤੁਹਾਨੂੰ ਮੇਲ ਕਰ ਦੇਣਾ ਜੀ ਉਹ ਅਤੇ ਇੱਥੇ ਬਾਕੀ ਕੋਲੇਜ ਦਾ ਆਪਣਾ ਸਿਸਟਮ ਵਗੈਰਾ ਸਾਰਾ ਸਹੀ ਹੈਗਾ ਸੈਲਰੀ ਵਗੈਰਾ ਦਾ ਕੀ ਸੀਨ ਆ ਜੀ ਇੱਥੇ ਅੱਛਾ ਜੀ ਟਾਈਮਲੀ ਸੈਲਰੀ ਆ ਜਾਂਦੀ ਹੈ ਜੀ ਹਾਂਜੀ ਠੀਕ ਹੈ ਜੀ ਅੱਛਾ ਠੀਕ ਆ ਜੀ ਹਾਂਜੀ ਹਾਂਜੀ ਫਿਰ ਤਾਂ ਬਿਲਕੁਲ ਸਹੀ ਹੈ ਜੀ ਮੈਂ ਫਲੈਟ ਦੇ ਵਿੱਚ ਵੀ ਰਹਿ ਸਕਦਾ ਜੀ ਇੱਥੇ ਹਾਂਜੀ ਫਿਰ ਤੁਸੀਂ ਗੱਲ ਕਰ ਲਿਓ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਹਾਂ ਹਾਂਜੀ ਹਾਂਜੀ ਹਾਂਜੀ ਓਕੇ ਜੀ